ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਦੱਸੋ ਬਹੁਤ ਵਧੀਆ ਤੁਸੀਂ ਸੁਣਾਓ ਜੀ ਕੀ ਸੇਵਾ ਕਰ ਸਕਦੇ ਅਸੀਂ ਤੁਹਾਡੀ ਪਰਿਵਾਰ ਬਸ ਵਧੀਆ ਜੀ ਕੀ ਸੇਵਾ ਕਰ ਸਕਦੇ ਹਾਂ ਤੁਹਾਡੀ ਹਾਂਜੀ ਹਾਂਜੀ ਹਾਂਜੀ ਸਰ ਅਸੀਂ ਕਾਫੀ ਜਗ੍ਹਾ 'ਤੇ ਅਸੀਂ ਵਿਜੀਟਰ ਨੂੰ ਲੈ ਕੇ ਜਾਂਦੇ ਆ ਟੂਰ ਦੇ ਵਾਸਤੇ ਤੁਸੀਂ ਜਿਵੇਂ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਪਰਿਵਾਰ ਦੇ ਨਾਲ ਜਾਣ ਦੀ ਕਸ਼ਮੀਰ ਵਾਲੇ ਪਾਸੇ ਸਾਈਡ ਕਸ਼ਮੀਰ ਦੇ ਵਿੱਚ ਕਾਫੀ ਜਗ੍ਹਾ ਜੀ ਘੁੰਮਣ ਨੂੰ ਜਿਵੇਂ ਆਪਣਾ ਜੰਮੂ ਦੇ ਵਿੱਚ ਹੈਗੀ ਜਗ੍ਹਾ ਕਾਫੀ ਉੱਥੇ ਇਤਿਹਾਸਿਕ ਗੁਰਦੁਆਰੇ ਵੀ ਜੀ ਮੰਦਿਰ ਵੀ ਨੇ ਹੋਰ ਵੀ ਦੇਖਣ ਵਾਲੀਆਂ ਕਾਫੀ ਜਗ੍ਹਾ ਨੇ ਅਤੇ ਜੇ ਤੁਸੀਂ ਕਸ਼ਮੀਰ ਦੀ ਗੱਲ ਕਰਦੇ ਹੋ ਕਸ਼ਮੀਰ ਦੇ ਵਿੱਚ ਵੀ ਗੁਲਮਾਰਗ ਹੈ ਸੋਨਮਾਰਗ ਹੈ ਇੱਕ ਜਿੱਥੇ ਵਰਲਡ ਦੇ ਵਿੱਚ ਸ ਸਭ ਤੋਂ ਵਧੀਆ ਜਗ੍ਹਾ ਉੱਥੇ ਕੇਸਰ ਦੀ ਖੇਤੀ ਹੁੰਦੀ ਆ ਉਹ ਵੀ ਹੈ ਉੱਥੇ ਦੇਖਣ ਨੂੰ ਹੋਰ ਵੀ ਆਪਣਾ ਦਰਿਆ ਹੋ ਗਏ ਪਹਾੜ ਪਹਾੜ ਵਗੈਰਾ ਹੋ ਗਏ ਕਾਫੀ ਕੁਛ ਹੈ ਅਤੇ ਇਹ ਸ਼੍ਰੀਨਗਰ ਦੇ ਵਿੱਚੇ ਹੈ ਜੀ ਇਹਦਾ ਪੈਕਜ ਜੀ ਤੁਹਾਨੂੰ ਤੁਸੀਂ ਕਿੰਨੇ ਜਣਿਆਂ ਨੇ ਜਾਣਾ ਅਤੇ ਕਦੋਂ ਜਾਣਾ ਕਿੰਨੇ ਦਿਨਾਂ ਲਈ ਜਾਣਾ ਉਹਦੇ ਲਈ ਇਹ ਅਲੱਗ ਅਲੱਗ ਹੈ ਜੀ ਦੇਖੋ ਰੂਮ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਤੁਸੀਂ ਰੂਮ ਲੈਣਾ ਹੋਟਲ ਕਿਸ ਤਰ੍ਹਾਂ ਦਾ ਲੈਣਾ ਇੱਕ ਦਾ ਪੰਜ ਹਜ਼ਾਰ ਰੇਟ ਹੈ ਇੱਕ ਦਾ ਦਸ ਹਜ਼ਾਰ ਹੈ ਇੱਕ ਦਾ ਪੰਦਰ੍ਹਾਂ ਇੱਕ ਦਾ ਵੀਹ ਇੱਕ ਦਾ ਪੱਚੀ ਇਸ ਤਰ੍ਹਾਂ ਕਾਫੀ ਰੇਂਜ ਹੈਗੀ ਸਾਡੇ ਕੋਲ ਜੀ ਇਹਦੇ ਵਿੱਚ ਸਰ ਅਟੈਚ ਵੋਸ਼ ਰੂਮ ਹੈ ਇਹ ਵੀ ਬਹੁਤ ਵਧੀਆ ਕਮਰਾ ਹੁੰਦਾ ਮੱਕਣਾ ਕਾਫੀ ਵਧੀਆ ਲੋਕੇਸ਼ਨ 'ਤੇ ਤੁਹਾਨੂੰ ਮਿਲੇਗਾ ਇਹ ਦੇਖਣ ਨੂੰ ਪਹਾੜਾਂ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦਸ ਦਿਓ ਜੀ ਦਸ ਦਿਓ ਜੀ ਦੱਸ ਦਿਓ